ਜਿਵੇਂ ਕਿ ਹੈ ਨਾ ਮੈਂ ਭਗਤ ਸਿੰਘ ਦੀ ਪੋਸਟਰ ਬਣਾਇਆ ਸੀ ਅਤੇ ਵੱਧ ਤੋਂ ਵੱਧ ਮੈਨੂੰ ਉਹਨੂੰ ਚੰਗੀ ਜਿਹੀ ਚੀਜ਼ ਬਣਾ ਲਈ ਕਿ ਇੱਕ ਇੱਕ ਚੀਜ਼ ਦੇਖਣ ਨੂੰ ਟੈਮ ਸਮਾਂ ਘੱਟ ਤੋਂ ਘੱਟ ਦੋ ਘੰਟੇ ਹੈ ਨਾ ਲੱਗ ਜਾਂਦੇ ਆ ਅਤੇ ਜਦੋਂ ਚੀਜ਼ ਪ੍ਰੋਪਰ ਬਣੇ ਹੈ ਨਾ ਕੋਈ ਗਲਤੀ ਕੋਈ ਇੱਧਰ ਉੱਧਰ ਹੋਵੇ ਨਾ ਨਾ ਕਿ ਮਤਲਬ ਪਿਆਰ ਨਾਲ ਬੰਦਾ ਬਣਾਵੇ ਆਰਾਮ ਨਾਲ ਹੈ ਨਾ ਅਤੇ ਘੱਟੋ ਘੱਟ ਸਕੈਚਿੰਗ ਕਰਨ ਨੂੰ ਦੋ ਘੰਟੇ ਤਾਂ ਲੱਗਦੇ ਨੌਰਮਲ ਜੇ ਲੱਗਦੇ ਆ ਹੈ ਨਾ ਅਤੇ ਜਿਵੇਂ ਕਿ ਦੀਵਾਰ 'ਤੇ ਬਣਾਉਂਦੇ ਆ ਹੈ ਨਾ ਬੜਾ ਜਿਹੜਾ ਕਾਰਟੂਨ ਟੈਪ ਹੋਵੇ ਹੈ ਨਾ ਡੋਰੇਮੋਨ ਦਿਖਾ ਕੇ ਤੁਹਾਨੂੰ ਪਤਾ ਡੋਰੇਮੋਨ ਬਹੁਤ ਮਸ਼ਹੂਰ ਆ ਹੈ ਨਾ ਅਤੇ ਉਹ ਤਾਂ ਮੈਂ ਦੀਵਾਰ 'ਤੇ ਬਣਿਆ ਤਾ ਆਪਣੇ ਘਰਾਂ ਹੈ ਨਾ ਉਹਦੇ ਲਈ ਮੈਨੂੰ ਘੱਟੋ ਘੱਟ ਇੱਕ ਡੇਢ ਦਿਨ ਤਾਂ ਲੱਗ ਗਿਆ ਸੀਗਾ ਮ ਇਕੱਲੀ ਇਕੱਲੀ ਚੀਜ਼ ਦੇਖਣੀ ਹੈ ਨਾ ਉਹਦਾ ਹੱਥ ਮੂੰਹ ਪੈਰ ਚੰਗੀ ਤਰ੍ਹਾਂ ਕਲਰਿੰਗ ਚੰਗੀ ਤਰ੍ਹਾਂ ਹੋਈ ਕਿ ਨਹੀਂ ਪੇਂਟਿੰਗ ਵੱਲੋਂ ਹੈ ਨਾ ਤਾਂ ਕਰਕੇ ਮਤਲਬ ਸਮਾਂ ਲੱਗਦਾ ਹੀ ਆ ਹੈ ਨਾ ਅਤੇ ਐਦੀ ਫਿਰ ਮੈਂ ਜਿੱਦਾਂ ਆਪਣੇ ਕੋਲਜ 'ਚ ਵੀ ਜੋਇਨ ਕੀਤਾ ਸੀ ਉਹ 'ਚ ਮਤਲਬ ਬਣਾਇਆ ਤਾ ਆਪਣਾ ਕੀ ਕਹਿੰਦੇ ਗਾਂਧੀ ਜੀ ਬਣਾਏ ਤੇ ਗਾਂਧੀ ਉਤਸਵ 'ਤੇ ਨਾ ਅਤੇ ਉਹਤੇ ਵੀ ਮੈਨੂੰ ਘੱਟੋ ਘੱਟ ਇੱਕ ਡੇਢ ਘੰਟਾ ਲੱਗ ਗਿਆ ਸੀ ਸਾਡੇ ਪੂਰੇ ਕੋਲਜ ਵਲੋਂ ਮਤਲਬ ਕੋਂਪੀਟੀਸ਼ਨ ਚੱਲਦੇ ਸੀ ਕਿ ਹਾਂ ਕਿ ਪੋਸਟਰ ਮੇਕਿੰਗ ਮੁਕਾਬਲਾ ਹੋਣਾ ਮਤਲਬ ਉਹ 'ਚ ਆਹਾ ਗਾਂਧੀ ਜੀ ਬਣਾਉਣੇ ਹੈ ਨਾ ਬਹੁਤ ਮਤਲਬ ਚੰਗੀ ਤਰੀਕੇ ਨਾਲ ਬਣਾਇਆ ਟੈਮ ਲੱਗ ਜਾਂਦਾ ਹਾਂ ਦੋ ਤਿੰਨ ਘੰਟੇ ਤਾਂ ਲੱਗੇ ਜਾਂਦੇ ਮੈਕਸੀਮਮ ਹੈ ਨਾ ਸਕੈਚਿੰਗ ਕਰਨੀ ਫਿਰ ਸ਼ੇਡ ਦੇਣੀ ਇਕੱਲੀ ਇਕੱਲੀ ਚੀਜ਼ ਹੈ ਨਾ ਹਾਂਜੀ ਤਾਂ ਕਰਕੇ ਇਹੀ ਕਹਿਣਾ ਚਾਹੁੰਦੀ ਹਾਂ ਮਤਲਬ ਕਿ ਮਤਲਬ ਬੰਦੇ ਨੂੰ ਜ਼ਿਆਦਾ ਸਮਾਂ ਲੱਗਦਾ ਤਾਂ ਹੀ ਜੇਕਰ ਤੁਸੀਂ ਦੇਖਣਾ ਪਹਿਲਾਂ ਕਿ ਚੀਜ਼ ਮਤਲਬ ਕਾਹਦੇ ਬਾਰੇ ਆ ਕਿੱਦਾਂ ਕਿਸ ਬੇਸ 'ਤੇ ਕਿੱਦਾਂ ਬਣਾਉਣੀ ਹੈ ਨਾ ਜੇ ਗਾਂਧੀ ਜੀ ਆ ਤਾਂ ਕਿੰਨਾ ਘੰਟੇ ਲੱਗਣ 'ਤੇ ਕੁਝ ਵੀ ਆ ਦੀਵਾਰ 'ਤੇ ਬਣਾਉਣਾ ਤਾਂ ਡੇਢ ਦਿਨ ਲੱਗਣਾ ਕਿ ਇੱਕ ਦਿਨ ਅਤੇ ਮੇਰਾ ਕਹਿਣ ਦਾ ਭਾਵ ਇਹ ਹੈ ਕਿ ਮਤਲਬ ਸਕੈਚਿੰਗ ਆ ਉਹਤੇ ਮਤਲਬ ਇੱਕ ਦਿਨ ਲੱਗਦਾ ਏ ਅਤੇ ਜਿੱਦਾਂ ਪੋਸਟਰ ਮੇ ਉਹਦਾ ਡੇਢ ਪੋਸਟਰ ਜਿੱਦਾਂ ਆਪਾਂ ਬਣਾਉਂਦੇ ਆ ਹੈ ਨਾ ਉਹਤੇ ਦੇ ਇੱਕ ਦੋ ਡੇਢ ਘੰਟਾ ਲੱਗਦਾ ਹੀ ਆ ਬਸ